ਹੈਲੋ ਯਾਰ ਤੂੰ ਕਿੱਥੋਂ ਆਉਂਦਾ ਹੈ ਤੂੰ ਕਿੱਥੋਂ ਆਉਂਦਾ ਮੈਂ ਤਾਂ ਤੇਰਾ ਤੋਂ ਆਉਂਦਾ ਹਾਂ ਅੱਜ ਕੱਲ੍ਹ ਤਾਂ ਬੱਸਾਂ ਦਾ ਹੀ ਬੜਾ ਪੰਗਾ ਹੈ ਟਾਈਮ ਸਿਰ ਆਉਂਦੀਆਂ ਹੀ ਨਹੀਂ ਹੈਗੀਆਂ ਜਦੋਂ ਕੋ ਸਕੂਲ ਜਾਂਦੇ ਹਾਂ ਅਤੇ ਲੇਟ ਹੋ ਜਾਂਦੇ ਹਾਂ ਤਾਂ ਮੈਡਮ ਸਾਨੂੰ ਪਨਿਸ਼ਮੈਂਟ ਦੇ ਦਿੰਦੀ ਹੈ ਅਤੇ ਸਾਨੂੰ ਬਾਹਰ ਖਲੋਣਾ ਪੈਂਦਾ ਕਿੰਨੀ ਕਿੰਨੀ ਦੇਰ ਸਾਡੀ ਕਲਾਸ ਹੀ ਨਹੀਂ ਲੱਗ ਪਾਉਂਦੀ ਇਹ ਬੱਸਾਂ ਕਰਕੇ ਬੱਸਾਂ ਪਹਿਲਾਂ ਤਾਂ ਟਾਈਮ ਸਿਰ ਆਉਂਦੀਆਂ ਹੀ ਨਹੀਂ ਅਸੀਂ ਦੂਰੋਂ ਪਿੰਡੋਂ ਪਿੰਡੋਂ ਆਉਣਾ ਹੁੰਦਾ ਹੋਰ ਕੀ ਸਹੀ ਗੱਲ ਹੈ ਅੱਜ ਕੱਲ੍ਹ ਦੇ ਜਮਾਨੇ 'ਚ ਕੌਣ ਦਿੰਦਾ ਸਹੀ ਗੱਲ ਹੈ ਅਤੇ ਫਿਰ ਜੇ ਇਹਨਾਂ ਦੀ ਸ਼ਿਕਾਇਤ ਕਰੋ ਬੱਸਾਂ ਵਾਲਿਆਂ ਦੀਆਂ ਤਾਂ ਇਹ ਸੁਣਦੇ ਹੀ ਨਹੀਂ ਹੈਗੇ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਹੁੰਦਾ

ਹਾਂ ਸਹੀ ਗੱਲ ਹੈ ਰੋਜ਼ ਲੇਟ ਪਹੁੰਚਦੇ ਸਹੀ ਗੱਲ ਹੈ ਇੱਕ ਤਾਂ ਖੁਦ ਟਾਈਮ 'ਤੇ ਬੱਸਾਂ ਆਉਂਦੀਆਂ ਨਹੀਂ ਅਤੇ ਉਲਟਾ ਸਾਨੂੰ ਹੀ ਉੱਥੋਂ ਪੈ ਜਾਂਦੀਆਂ ਸਕੂਲ 'ਚੋਂ ਹੋਰ ਕੀ